ਹਾਂ ਕਾਨੂੰਨ ਪ੍ਰਣਾਲੀ ਇਹਦੇ ਬਾਰੇ ਤਾਂ ਕੀ ਕਿਹਾ ਜਾਵੇ ਕਾਨੂੰਨ ਪ੍ਰਣਾਲੀ ਕਦੇ ਵੀ ਨਹੀਂ ਵਿਸ਼ਵਾਸ ਕਰਨ ਲੋਕ ਹੈ ਜਿਹੜੇ ਉਹ ਖੜ੍ਹੇ ਪੈਰ 'ਤੇ ਮੁੱਕਰ ਜਾਂਦੇ ਆ ਪੈਸਾ ਦੇ ਕੇ ਨਾਲ ਦੀ ਨਾਲ ਗਵਾਹ ਖਰੀਦ ਲੈਂਦੇ ਆ ਇੱਥੋਂ ਤੱਕ ਕਿ ਵਕੀਲ ਤੱਕ ਜੱਜ ਤੱਕ ਖਰੀਦ ਲੈਂਦੇ ਆ ਕਾਨੂੰਨ ਪ੍ਰਣਾਲੀ ਇੰਨੀ ਵਿਕਲਪ ਰੂਪ ਨਾਲ ਸਹੀ ਨਹੀਂ ਹੈਗੀ ਬਿਲਕੁਲ ਵੀ ਨਹੀਂ ਅੰਸ਼ਕਤਾ ਬਿਲਕੁਲ ਵੀ ਨਹੀਂ ਇਹ ਤਾਂ ਵਿਸ਼ਵਾਸ ਅਵਿਸ਼ਵਾਸਵਾਦੀ ਹੈ ਇਹਦੇ 'ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੈ ਕਾਨੂੰਨ ਪ੍ਰਣਾਲੀ 'ਤੇ ਵਿਸ਼ਵਾਸ ਕਰਨਾ ਬਹੁਤ ਬਹੁਤ ਕਠਿਨ ਹੁੰਦਾ ਖੜ੍ਹੇ ਪੈਰ 'ਤੇ ਬੰਦਾ ਮੁਕਰਾ ਦਿੰਦੇ ਇਹ ਤਾਂ